ਭੰਗੜੇ ਬਾਰੇ ਕੁਝ ਗਲਤ ਧਾਰਨਾਵਾਂ ਨੇ ਅਤੇ ਇਹਨਾਂ ਦੇ ਹੱਲ ਵੀ ਹੈ ਜਿਨ੍ਹਾਂ ਦੇ ਵਿੱਚੋਂ ਖ਼ਾਸ ਹੈ ਸੱਟ ਲੱਗਣ ਦਾ ਡਰ ਇਸ ਨਾਲ ਗਿੱਟੇ ਗੋਡੇ ਅਤੇ ਪਿੱਠ ਦੀ ਸੱਟ ਦਾ ਡਰ ਰਹਿੰਦਾ ਪਰ ਜੇ ਅਸੀਂ ਸਮਤਲ ਜਗ੍ਹਾ 'ਤੇ ਚੰਗੇ ਅਧਿਆਪਕ ਦੀ ਨਿਗਰਾਨੀ ਹੇਠ ਭੰਗੜੇ ਦੀ ਪ੍ਰੈ ਅਭਿਆਸ ਕਰਾਂਗੇ ਤਾਂ ਕਿਸੇ ਤਰ੍ਹਾਂ ਦੀ ਕੋਈ ਸੱਟ ਦਾ ਖ਼ਤਰਾ ਨਹੀਂ ਰਹਿੰਦਾ ਹੋਰ ਧਾਰਨਾ ਹੈ ਕਿ ਹਰ ਕੋਈ ਭੰਗੜਾ ਨਹੀਂ ਪਾ ਸਕਦਾ ਜੋ ਕਿ ਬਿਲਕੁਲ ਗਲਤ ਹੈ ਭੰਗੜਾ ਇੱਕ ਤਰਤੀਬ ਬਧ ਸਰੀਰ ਦੇ ਸਾਰੇ ਅੰਗਾਂ ਨੂੰ ਜੋਸ਼ ਨਾਲ ਹਿਲਾਉਣ ਦੀ ਵਿਧੀ ਹੈ ਜਿਸ ਨਾਲ ਸਰੀਰ ਵਿੱਚ ਲਹੂ ਦਾ ਸੰਪੂਰਨ ਸੰਚਾਰ ਹੁੰਦਾ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਹਰ ਕੋਈ ਭੰਗੜਾ ਪਾ ਸਕਦਾ ਏ ਆ ਹੋਰ ਧਾਰਨਾ ਹੈ ਕਿ ਇਸ ਲਈ ਬਹੁਤ ਅਭਿਆਸ ਅਤੇ ਸਿੱਖਣ ਦੀ ਲੋੜ ਹੁੰਦੀ ਹੈ ਜਦਕਿ ਅਜਿਹਾ ਕੁਛ ਨਹੀਂ ਹੁੰਦਾ ਜਦੋਂ ਸਰੀਰ ਇੱਕ ਵਾਰ ਲੋਰ 'ਚ ਆ ਕੇ ਢੋਲ ਦੀ ਧਮਕ ਨਾਲ ਬਹਿ ਤੁਰਦਾ ਤਾਂ ਭੰਗੜਾ ਆਪਣੇ ਆਪ ਹੀ ਫੁੱਟ ਪੈਂਦਾ ਆ ਇਸ ਦੇ ਉੱਤੇ ਜ਼ਿਆਦਾ ਜ਼ੋਰ ਦੇਣ ਦੀ ਲੋੜ ਨਹੀਂ ਪੈਂਦੀ ਹੋਰ ਧਾਰਨਾ ਹੈ ਕਿ ਭੰਗੜਾ ਸਿੱਖਣਾ ਅਤੇ ਪਾਉਣਾ ਮਹਿੰਗਾ ਪੈਂਦਾ ਆ ਪਰ ਇਹ ਬਿਲਕੁਲ ਵੀ ਗਲਤ ਆ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਬਹੁਤ ਸਾਰੇ ਮੁਫ਼ਤ ਕੈਂਪ ਲੱਗਦੇ ਨੇ ਜਿਨ੍ਹਾਂ ਦਾ ਹਰ ਕੋਈ ਲਾਭ ਉਠਾ ਸਕਦਾ ਆ ਇਹ ਇਨਸਾਨ ਨੂੰ ਮਨੋ ਤਨੋ ਤੰਦਰੁਸਤ ਕਰਦਾ ਆ ਭੰਗੜਾ ਜ਼ਿੰਦਗੀ 'ਚ ਖੇੜਾ ਲੈ ਕੇ ਆਉਂਦਾ ਆ